ਅੱਜ ਕੱਲ੍ਹ ਦਾ ਜਿਹੜਾ ਸਮਾਂ ਆ ਉਹ ਤਕਨੋਲੋਜੀ ਦਾ ਸਮਾਂ ਆ ਅਤੇ ਟੈਕਨੋਲਜੀ ਨੇ ਸਾਡੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਬਦਲਾਅ ਕੀਤਾ ਆ ਟੈਕਨੋਲਜੀ ਨੇ ਬੈਂਕਿੰਗ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਆ ਅਤੇ ਬੈਂਕਿੰਗ ਨੂੰ ਵੀ ਬਹੁਤ ਜ਼ਿਆਦਾ ਆਸਾਨ ਬਣਾਇਆ ਆ ਜਿਵੇਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਬਹੁਤ ਸਾਰੇ ਜਿਹੜੇ ਬੈਂਕ ਦੇ ਕੰਮ ਸੀਗੇ ਉਹ ਹੱਥੀਂ ਮੈਨੁਲੀ ਹੁੰਦੇ ਸੀਗੇ ਕੰਮ ਹੱਥੀਂ ਹੁੰਦੇ ਸੀਗੇ ਬਟ ਅੱਜ ਜਿਹੜਾ ਕੰਮ ਆ ਉਹ ਬੈਂਕ ਦੇ ਜਿੰਨੇ ਵੀ ਸਾਰੇ ਕੰਮ ਆ ਉਹ ਆਨਲਾਈਨ ਹੁੰਦੇ ਜਾ ਰਹੇ ਆ ਜਿਵੇਂ ਕਿ ਪਹਿਲਾਂ ਟਰਾਂਜੈਕਸ਼ਨ ਦਾ ਕੰਮ ਵੀ ਬੈਂਕ ਦੇ ਵਿੱਚ ਜਾ ਕੇ ਹੀ ਹੁੰਦਾ ਸੀ ਅੱਜ ਕੱਲ੍ਹ ਫੋਨ ਦੇ ਵਿੱਚ ਅਸੀਂ ਆਪਣੇ ਫੋਨ ਦੇ ਵਿੱਚ ਬਹੁਤ ਸਾਰੇ ਐਪ ਜਿਵੇਂ ਕਿ ਗੂਗਲ ਪੇ ਫੋਨਪੇ ਪੇਟੀਐਮ ਵਗੈਰਾ ਆਪਣੇ ਫੋਨ ਦੇ ਵਿੱਚ ਭਰ ਕੇ ਇੱਕ ਦੂਸਰੇ ਨੂੰ ਟਰਾਂਜੈਕਸ਼ਨ ਕਰ ਸਕਦੇ ਹਾਂ ਅਸੀਂ ਕਿਸੇ ਤੋਂ ਪੈਸੇ ਮੰਗਵਾ ਵੀ ਸਕਦੇ ਹਾਂ ਕਿਸੇ ਨੂੰ ਪੈਸੇ ਭੇਜ ਵੀ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋਈਏ ਅਸੀਂ ਬਾਹਰਲੇ ਦੇਸ਼ ਤੋਂ ਵੀ ਪੈਸੇ ਮੰਗਵਾ ਸਕਦੇ ਹਾਂ ਅਤੇ ਉਹਨਾਂ ਨੂੰ ਭੇਜ ਵੀ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਆ ਬੈਂਕ ਦੇ ਉਹ ਆਨਲਾਈਨ ਹੋ ਰਹੇ ਆ ਕੋਈ ਵੀ ਬੈਂਕ ਦਾ ਹਿਸਾਬ ਕਿਤਾਬ ਉਹ ਵੀ ਟੈਕਨੋਲੋਜੀ ਦੇ ਜ਼ਰੀਏ ਆਸਾਨ ਹੋ ਗਿਆ ਉਹ ਵੀ ਆਨਲਾਈਨ ਹੀ ਹੁੰਦਾ ਆ ਅਸੀਂ ਕੋਈ ਵੀ ਬੈਂਕ ਦੀ ਨੌਕਰੀ ਦੇ ਲਈ ਅਵੇਦਨ ਕਰਨਾ ਹੋਵੇ ਕੋਈ ਫੋਰਮ ਫਿਲ ਕਰਨਾ ਹੋਵੇ ਉਹ ਵੀ ਅਸੀਂ ਘਰ ਬੈਠੇ ਹੀ ਭਰ ਸਕਦੇ ਹਾਂ ਬਹੁਤ ਸਾਰੇ ਜਿਹੜੇ ਕੰਮ ਆ ਸਾਡੇ ਉਹ ਟੈਕਨੋਲਜੀ ਦੇ ਨਾਲ ਹੋ ਹੋ ਗਏ ਹਨ ਹਾਂ ਸਭ ਤੋਂ ਜਿਹੜਾ ਮੇਨ ਮੇਨ ਕੰਮ ਜਿਸ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਆਸਾਨ ਬਣਾਇਆ ਹੈ ਉਹ ਹੈ ਏ ਟੀ ਐਮ ਏ ਟੀ ਐਮ ਮਸ਼ੀਨ ਏ ਟੀ ਐਮ ਮਸ਼ੀਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਅ ਆਸਾਨ ਬਣਾਇਆ ਹੈ ਏ ਟੀ ਐਮ ਇੱਦਾਂ ਦੀ ਮਸ਼ੀਨ ਆ ਮਤਲਬ ਅਸੀਂ ਕਿਸੇ ਵੀ ਟਾਈਮ ਪੈਸੇ ਨੂੰ ਕਢਵਾ ਸਕਦੇ ਹਾਂ ਮਤਲਬ ਸਾਨੂੰ ਬੈਂਕਾਂ ਦੇ ਵਿੱਚ ਜਾ ਕੇ ਖੜੇ ਹੋਣ ਦੀ ਟਾਈਮ ਵੇਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਅਤੇ ਏ ਟੀ ਐਮ ਨਾਲ ਸਾਡਾ ਜਿਹੜਾ ਜੀਵਨ ਆ ਉਹ ਬਹੁਤ ਜ਼ਿਆਦਾ ਆਸਾਨ ਆ ਅਤੇ ਮਨੁੱਖੀ ਦਖ਼ਲ ਅੰਦਾਜੀ ਦੀ ਜਿਹੜੀ ਘਾਟ ਆ ਨਾ ਉਸਨੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਉਲਝਣ ਪੈਦਾ ਨਹੀਂ ਕੀਤੀ ਆ ਕਿਉਂਕਿ ਸਾਨੂੰ ਸਾਰੇ ਕੰਮ ਜਿਹੜੇ ਆ ਆਨਲਾਈਨ ਜੋ ਮਿਲ ਰਹੇ ਆ ਬੈਂਕ ਦੀ ਬੈਂਕ ਦੇ ਕੰਮ ਜਿਹੜੇ ਆਨਲਾਈ ਹੋ ਆਨਲਾਈਨ ਹੋ ਰਹੇ ਆ ਉਹਨਾਂ ਨਾਲ ਸਾਡੀ ਜਿਹੜੀ ਜ਼ਿੰਦਗੀ ਆ ਉਹ ਸਹੀ ਹੋ ਰਹੀ ਆ ਅਤੇ ਮਤਲਬ ਠੀਕ ਹੋ ਰਹੀ ਆ ਆਸਾਨ ਬਣ ਰਹੀ ਆ